ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੱਸੋ ਕੀ ਹਾਲ ਚਾਲ ਹੈ ਜੀ ਬਸ ਆਪਣਾ ਵੀ ਵਧੀਆ ਜੀ ਆਪਣਾ ਵੀ ਵਧੀਆ ਦੇਖੋ ਜੀ ਬੇਅੰਤ ਸਿੰਘ ਕੋਲੇਜ 'ਚ ਬਹੁਤ ਹੀ ਵਧੀਆ ਕੋਲੇਜ ਹੈ ਇੱਥੇ ਦੇ ਟੀਚਰ ਵੀ ਕਾਫ਼ੀ ਮਦਦ ਕਰਦੇ ਹਨ ਅਤੇ ਬੱਚੇ ਵੀ ਹੁਸ਼ਿਆਰ ਨੇ ਇੱਦਾਂ ਦੀ ਤਾਂ ਕੋਈ ਗੱਲ ਨਹੀਂ ਸਗੋਂ ਮੈਂ ਕਹਿੰਦਾ ਕਿ ਸਭ ਤੋਂ ਵੈਸਟ ਫੈਕਿਲਟੀ ਹੈ ਲਾ ਆ ਆਲੇ ਦੁਆਲੇ ਦੇਖਿਆ ਜਾਵੇ ਅਤੇ ਬਾਕੀ ਕੋਲੇਜਾਂ ਨਾਲ ਕੰਪੇਅਰ ਕੀਤਾ ਜਾਵੇ ਤਾਂ ਬਾਕੀ ਵੀ ਹੋਰ ਬਥੇਰਾ ਕੁਛ ਹੈ ਦੇਖਣ ਨੂੰ ਜੇ ਕਹਿ ਸਕਦੇ ਕਿ ਕੰਪਿਊਟਰ ਵੀ ਹੈਗਾ ਜਿਹੜੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਅਤੇ ਨਾਲੇ ਹੋਰ ਵੀ ਬਥੇਰੀ ਐਕਸਟਰਾ ਐਕਟੀਵਿਟੀਸ ਵੀ ਕੀਤੀਆਂ ਜਾਂਦੀਆਂ ਨੇ ਜਿਹੜੀ ਬੱਚੇ ਨੂੰ ਬਹੁਤ ਤਰੀਕੇ ਨਾਲ ਹੈਲਪ ਕਰਦੀਆਂ ਨੇ ਹੋਸਟਲ ਵੀ ਦੇਖੋ ਜੀ ਵਧੀਆ ਸਾਰੀ ਦੀ ਸਾਰੀ ਦੇਖੋ ਜੀ ਖਾਣਾ ਪੀਣਾ ਵੀ ਵਧੀਆ ਉੱਥੇ ਤਾਂ ਵੈਸੇ ਤਾਂ ਮੇਨ ਖਾਣਾ ਪੀਣਾ ਹੀ ਹੁੰਦਾ ਜੀ ਖਾਣਾ ਪੀਣਾ ਤਾਂ ਵਧੀਆ ਜੀ ਉੱਥੋਂ ਦਾ ਅਤੇ ਉੱਥੋਂ ਦਾ ਮਾਹੌਲ ਵੀ ਵਧੀਆ ਪੜ੍ਹਨ ਲਿਖਣ ਵਾਲੇ ਬੱਚੇ ਹੈਗੇ ਨੇ ਇਸ ਵਾਰ ਹੋਸਟਲ 'ਚ ਸੁਣਿਆ ਮੈਂ ਓਕੇ ਬਾਏ ਓਕੇ ਬਾਏ ਓਕੇ ਬਾਏ